ਹਾਂਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ

ਹਾਂਜੀ ਮੈਡਮ ਬੜੇ ਪਠਾਨਕੋਟ 'ਚ ਬੜੇ ਢਾਬੇ ਨੇ ਢਾਬੇ ਜਿਹੜੇ ਆ ਇੱਕ ਤਾਂ ਰੈਸਟੋਰੈਂਟ ਵੀ ਇੱਥੇ ਹੈਗੇ ਹੈ ਹਵੇਲੀ ਡੋਮੀਨੋਜ਼ ਸਾਰੇ ਇੱਥੇ ਹੈਗੇ ਆ ਮੈਮ ਹਾਂਜੀ ਹਾਂ ਮੈਮ ਠੀਕ ਹੈ ਜੈਨੂਅਲ ਰੇਟ ਹੀ ਹੈ ਅ ਮੈਡਮ ਜਿਹੜੇ ਢਾਬੇ ਉਹ ਤਾਂ ਚੌਵੀ ਘੰਟੇ ਖੁੱਲ੍ਹੇ ਹੁੰਦੇ ਆ ਅਤੇ ਜਿਹੜਾ ਕੋਈ ਫਾਸਟ ਫੂਡ ਵਗੈਰਾ ਉਹ ਮੈਡਮ ਮਾਰਕਿਟ ਦਸ ਵਜੇ ਬੰਦ ਹੋ ਜਾਂਦੀ ਫਾਸਟ ਫੂਡ ਵਾਲੀ ਜੀ ਠੀਕ